ਯੋਗਾ ਨੂੰ ਸ਼ੌਕ ਵਜੋਂ ਅਪਨਾਉਣ ਲਈ ਸਾਡੇ ਗੁਰੂਆਂ ਨੇ ਹੀ ਸਾਨੂੰ ਪ੍ਰੇਰਿਤ ਕੀਤਾ ਹੈ ਉਹ ਸਵੇਰੇ ਅੰਮ੍ਰਿਤ ਵੇਲੇ ਢਾਈ ਵਜੇ ਉੱਠ ਕੇ ਇਸ਼ਨਾਨ ਕਰਨਾ ਅਤੇ ਫਿਰ ਉਨ੍ਹਾਂ ਨੇ ਆਪਦਾ ਸ਼ਰੀਰ ਤੰਦਰੁਸਤ ਰੱਖਣ ਵਾਸਤੇ ਯੋਗਾ ਦਾ ਯੋਗਾ ਕਰਨੀ ਉਨ੍ਹਾਂ ਨੂੰ ਵੇਖਦੇ ਵੇਖਦੇ ਸਾਨੂੰ ਵੀ ਥੋੜ੍ਹਾ ਥੋੜ੍ਹਾ ਅਭਿਆਸ ਹੋਣਾ ਸ਼ੁਰੂ ਹੋ ਗਿਆ ਅਤੇ ਅਸੀਂ ਵੀ ਆਪਦੇ ਸ਼ਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਯੋਗਾ ਦਾ ਅਭਿਆਸ ਕਰਨ ਲੱਗ ਗਏ ਯੋਗਾ ਦੇ ਅਭਿਆਸ ਨਾਲ ਸਾਡਾ ਸਰੀਰ ਇੰਨਾ ਕੁ ਸਵਸਥ ਏ ਕਿ ਸਾਡੇ ਕੋਲ ਕੋਈ ਬਿਮਾਰੀ ਨਹੀਂ ਹੈਗੀ ਸਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਕੋਈ ਲੋੜ ਨਹੀਂ ਹੈਗੀ ਇਸ ਕਰਕੇ ਸਾਨੂੰ ਯੋਗਾ ਬਹੁਤ ਪਸੰਦ ਹੈ